ਖੇਡਣ ਲਈ ਮੈਂ ਜ਼ਿਆਦਾਤਰ ਆਰ ਪੀ ਜੀ ਗੇਮਾਂ ਵਾਸਤੇ ਜਾਂਦਾ ਹਾਂ ਅਤੇ ਕੋਈ ਰਣਨੀਤੀ ਵਾਲੀ ਗੇਮ ਜਿੱਦਾਂ ਸ਼ਤਰੰਜ ਹੋ ਗਈ ਅਤੇ ਆਰ ਪੀ ਜੀ ਵਾਸਤੇ ਮੈਂ ਕੋਈ ਵੀ ਅ ਜਿਹੜੀ ਚਲ ਚਲਦੀ ਫਿਰਦੀ ਗੇਮ ਹੋਵੇ ਜਿਵੇਂ ਪਬਜੀ ਚਲਦੀ ਪਈ ਸੀ ਹੁਣ ਕੋਲਰਬ੍ਰਿਟੀ ਆਉਂਦੀ ਪਈ ਆ ਤਾਂ ਨੋ ਜ਼ਿਆਦਾਤਰ ਮੈਂ ਉਹ ਹੀ ਗੇਮਾਂ ਖੇਡਦਾ ਹਾਂ ਇਹ ਜ਼ਿਆਦਾਤਰ ਕਿ ਦਿਮਾਗ 'ਤੇ ਉੱਤੇ ਕੋਈ ਸਟਰੈਸ ਵਗੈਰਾ ਆਇਆ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਠੀਕ ਕਰਨ ਵਾਸਤੇ ਵਿਚਾਰ ਲੈਂਦੀ ਆ ਮੇਰੇ ਵਾਸਤੇ ਅਤੇ ਇੱਕ ਮਜ਼ਾ ਤਾਂ ਆਉਂਦਾ ਵਾ ਟਾਈਮ ਪਾਸ ਕਰਨ ਵਾਸਤੇ ਵਧੀਆ ਹੋਣ ਅਤੇ ਰਣਨੀਤੀ ਵਾਲੀ ਗੇਮ ਜਿਦੇ ਦੀ ਸ਼ਤਰੰਜ ਹੋ ਗਈ ਉਹ ਖੇਡਣ ਵਿੱਚ ਦਿਮਾਗ ਜ਼ਿਆਦਾ ਲੱਗਦਾ ਅਤੇ ਦਿਮਾਗ ਤੇਜ਼ ਹੁੰਦਾ ਮੇਰੇ ਹਿਸਾਬ ਤੇ ਤੋ ਤਾਂ ਕਰਕੇ ਮੈਂ ਉਹ ਉਸ ਗੇਮ ਵਾਸਤੇ ਜਾਣਾ ਚਾਹੁੰਦਾ ਹਾਂ ਅਤੇ ਕਈ ਵਾਰੀ ਮੇਰਾ ਮਨ ਵੀ ਕੀਤਾ ਕਿ ਜ਼ਿਆਦਾ ਦੇਰ ਤੱਕ ਖੇਡਾਂ ਜ਼ਿਆਦਾ ਵਧੀਆ ਪਰਫੋਰਮ ਕਰ ਕੇ ਇਹਦੇ ਵਿੱਚ ਕੀ ਅੱਗੇ ਵੀ ਇਸ ਗੇਮ ਨੂੰ ਲੈ ਕੇ ਜਾਵਾਂ ਕਿਸੇ ਹੋਰ ਜਗ੍ਹਾ 'ਤੇ ਅਤੇ ਆਰ ਪੀ ਜੀ ਗੇਮ ਮਤਲਬ ਉਹੀ ਸਟਰੈਸ ਰਿਲੀਫ ਅਤੇ ਦਿਮਾਗ ਠੰਡਾ ਕਰਨ ਵਾਸਤੇ ਕਵਾਂ ਦੀ